ਹੈਲੋ ਭਾਅ ਜੀ ਤੁਸੀਂ ਪ੍ਰੀਡੀਲੈਕਸ ਤੋਂ ਬੋਲ ਰਹੇ ਹੋ ਜੀ ਮੈਂ ਮਨੀ ਬੋਲ ਰਿਹਾ ਜੀ ਰੈਲਮਾਜਰੇ ਤੋਂ ਜੀ ਹਾਂਜੀ ਜੀ ਮੈਂ ਵੀਹ ਕੁ ਮਿੰਟ ਪਹਿਲਾਂ ਤੁਹਾਡੇ ਉਹਦੇ ਪਰ ਸ਼ੋਪ ਪਰ ਜੀ ਮੈਂ ਔਰਡਰ ਕੀਤਾ ਸੀਗਾ ਜੀ ਖਾਣਾ ਤਾਂ ਇਸ ਲਈ ਖਾਣੇ ਵਿੱਚ ਮੈਂ ਕੀਤਾ ਸੀਗਾ ਜੀ ਦਾਲ ਮੱਖਣੀ ਕੀਤਾ ਸੀਗਾ ਜੀ ਸ਼ਾਹੀ ਪਨੀਰ ਕੀਤੀ ਸੀਗੀ ਜੀ ਤਾਂ ਤੰਦੂਰੀ ਰੋਟੀਆਂ ਕੀਤੀਆਂ ਸੀਗੀ ਜੀ ਮੈਂ ਔਰਡਰ ਕੀਤੀਆਂ ਸੀਗੀਆਂ ਇਸ ਕਰਕੇ ਮੇਰੇ ਘਰ ਗੈਸਟ ਆਏ ਹੋਏ ਸੀਗੇ ਜੀ ਤਾਂ ਹਾਂ ਮੇਰੇ ਘਰ ਦੇ ਜੀ ਇਸ ਲੀਏ ਉਹ ਨਾ ਖਾਣਾ ਬਣਾ ਨਹੀਂ ਸਕੇ ਛੇਤੀ ਛੇਤੀ ਇਸ ਕਰਕੇ ਮੇਰੀ ਮਾਤਾ ਜੀ ਨੇ ਮੈਨੂੰ ਕਿਹਾ ਜੀ ਵੀ ਤੁਸੀਂ ਪ੍ਰੀਡੀਲੈਕਸ ਤੋਂ ਹੀ ਔ ਔਰਡਰ ਕਰ ਸਕਦੇ ਹੋ ਕਰ ਦਿਉ ਜੀ ਖਾਣਾ ਤਾਂ ਮੈਂ ਤੁਹਾਡੇ ਪ੍ਰੀਡੀਲੈਕਸ ਹੋਟਲ ਪਰੋ ਜੀ ਮੈਂ ਖਾਣਾ ਔਰਡਰ ਕਰ ਦਿੱਤਾ ਸੀਗਾ ਜੀ ਤਾਂ ਖਾਣਾ ਮੈਨੂੰ ਜੀ ਸਮੇਂ ਸਿਰ ਪਹੁੰਚ ਗਿਆ ਸੀਗਾ ਜੀ ਇਸ ਲਈ ਖਾਣਾ ਗਰਮ ਗਰਮ ਸੀਗਾ ਜੀ ਤਾਂ ਇਸ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਠੀਕ ਹੈ ਜੀ ਖਾਣਾ ਬਹੁਤ ਵਧੀਆ ਲੱਗਿਆ ਜੀ ਸਾਡੇ ਰਿਸ਼ਤੇਦਾਰਾਂ ਨੂੰ ਜੀ ਸਾਡੇ ਰਿਸ਼ਤੇਦਾਰਾਂ ਨੇ ਵੀ ਮੇਰਾ ਧੰਨਵਾਦ ਕੀਤਾ ਜੀ ਖਾਣਾ ਬਹੁਤ ਵਧੀਆ ਬਣਾਇਆ ਹੋਇਆ ਸੀਗਾ ਜੀ ਤਾਂ ਜਦ ਕਦੇ ਵੀ ਮੈਂ ਔਰਡਰ ਕਰਨਾ ਹੋਵੇਗਾ ਜੀ ਤਾਂ ਖਾਣਾ ਮੈਂ ਤੁਹਾਡੇ ਹੀ ਹੋਟਲ ਪਰੋ ਔਰਡਰ ਕਰ ਸਕਾਂਗਾ ਜੀ ਇਸ ਲਈ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਤੁਹਾਨੂੰ ਫੋਨ ਕੀਤਾ ਸੀਗਾ ਜੀ ਤਾਂ ਇਸ ਲੀਏ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਥੈਂਕ ਯੂ ਜੀ ਇਸ ਲਈ ਓਕੇ ਜੀ ਬਾਏ